ਮੈਨੂੰ ਗਾਉਣਾ ਬਹੁਤ ਪਸੰਦ ਹੈ ਇਸ ਲਈ ਮੈਂ ਗਾਇਕੀ ਦੇ ਪ੍ਰਦਰਸ਼ਨ ਲਈ ਮੈਂ ਬਹੁਤ ਜਗ੍ਹਾ ਤੋਂ ਪੁੱਛਦੀ ਹਾਂ ਜਿਹਨੂੰ ਗਾਇਕੀ ਜਾਂ ਗਾਉਣ ਦੇ ਬਾਰੇ ਨੌਲੇਜ ਹੁੰਦੀ ਹੈ ਜਿਵੇਂ ਕਿ ਜਿਹਨੂੰ ਵਧੀਆ ਗਾਉਣਾ ਆਉਂਦਾ ਜਿਵੇਂ ਕਿ ਮੈਂ ਮੇਰੀ ਸੇਹਲੀਆਂ ਦੀ ਮਦਦ ਲੈਂਦੀ ਹਾਂ ਅਤੇ ਟੀਚਰਾਂ ਕੋਲੋਂ ਵੀ ਪੁੱਛ ਲੈਂਦੀ ਹਾਂ ਕਿ ਕਿਵੇਂ ਗਾਉਣਾ ਚਾਹੀਦਾ ਹੈ ਅਤੇ ਕਿਵੇਂ ਤਾਲ ਸੁਰ ਚੁੱਕਣੇ ਚਾਹੀਦੇ ਹਨ ਅਤੇ ਉਹ ਮੇਰੀ ਬਹੁਤ ਹੈਲਪ ਕਰਦੇ ਹੈ ਅਤੇ ਸਾਡੇ ਰਿਸ਼ਤੇਦਾਰ ਵੀ ਦੱਸ ਦਿੰਦੇ ਹੈ ਕਿ ਕਿੱਥੇ ਤੁਹਾਡੀ ਗਲਤੀ ਹੈ ਅਤੇ ਕਿਵੇਂ ਬੋਲਣਾ ਹੈ ਤਾਂ ਫਿਰ ਮੈਂ ਬੋਲਦੀ ਹਾਂ ਅਤੇ ਰਿਕੋਰਡਿੰਗ ਮਤਲਬ ਪ੍ਰੈਕਟਿਸ ਕਰਦੀ ਹਾਂ ਅਤੇ ਬਾਅਦ ਵਿੱਚ ਅਸੀਂ ਅਸੀਂ ਵੀ ਗਾਇਕੀ ਬਾਰੇ ਇੰਟਰਨੈਟ 'ਤੇ ਵੀ ਸਰਚ ਕਰ ਲੈਂਦੀ ਹਾਂ ਅਤੇ ਉਹ ਉੱਥੇ ਵਾਧੂ ਸੁਵਿਧਾਵਾਂ ਵੀ ਮਿਲਦੀ ਹੈ ਕਿਵੇਂ ਬੋਲਣਾ ਚਾਹੀਦਾ ਹੈ ਅਤੇ ਸਾਨੂੰ ਕਿਵੇਂ ਗਾਉਣਾ ਚਾਹੀਦਾ ਹੈ ਸਾਡੀ ਆਵਾਜ਼ ਵਿੱਚ ਮਤਲਬ ਡਰ ਨਹੀਂ ਹੋਣਾ ਚਾਹੀਦਾ ਗਾਇਕੀ ਵਧੀਆ ਤਰੀਕੇ ਵਧੀਆ ਢੰਗ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਐਵੇਂ ਮਹਿਸੂਸ ਕਰੀਏ ਕਿ ਅਸੀਂ ਗਾਇਕੀ 'ਚ ਹੀ ਡੁੱਬ ਗਏ ਹੈ ਸਾਡੇ ਆਸ ਪਾਸ ਕੋਈ ਨਹੀਂ ਹੈ ਮਤਲਬ ਸਿਰਫ਼ ਉਸ ਗਾਣੇ 'ਤੇ ਹੀ ਫੋਕਸ ਕਰਨਾ ਚਾਹੀਦਾ ਹੈ ਕਿ ਜਿਵੇਂ ਅਸੀਂ ਮਤਲਬ ਜੋ ਅਸੀਂ ਗਾ ਰਹੇ ਹਾਂ ਮੈਨੂੰ ਜਿਵੇਂ ਕਿ ਪੰਜਾਬੀ ਸੌਂਗ ਬਹੁਤ ਪਸੰਦ ਹੈ ਮੈਂ ਉਹਨਾਂ ਦੀ ਤਿਆਰੀ ਕਰਦੀ ਹਾਂ ਕਿ ਮੈਂ ਉਹਨਾਂ ਨੂੰ ਬੋਲ ਬੋਲਦੀ ਹਾਂ ਕਿਵੇਂ ਬੋਲਣਾ ਹੈ ਅਤੇ ਫਿਰ ਮੈਂ ਘਰਦਿਆਂ ਦੇ ਅੱਗੇ ਵੀ ਬੋਲ ਕੇ ਸੁਣਾਉਂਦੀ ਫਿਰ ਮੈਨੂੰ ਘਰਦੇ ਦੱਸਦੇ ਨੇ ਕਿ ਇੱਥੇ ਥੋੜ੍ਹੀ ਜਿਹੀ ਤੇਰੀ ਗਲਤੀ ਹੈ ਤੂੰ ਇਸ 'ਤੇ ਥੋੜ੍ਹਾ ਬੇ ਸਹੀ ਕਰ ਇੱਥੇ ਥੋੜ੍ਹੀ ਸੁਰ ਲਗਾ ਫਿਰ ਮੈਂ ਫਿਰ ਬੋਲ ਕੇ ਦਿਖਾਉਂਦੀ ਹਾਂ ਇਸ ਤਰ੍ਹਾਂ ਮੇਰੀ ਜੋ ਗਾਇਕੀ ਹੈ ਉਸ ਵਿੱਚ ਪਰਿਵਰਤਨ ਆਉਂਦਾ ਹੈ ਇਸ ਤਰ੍ਹਾਂ ਰਿਕੋਰਡਿੰਗ ਸੈਸ਼ਨ ਦੀ ਤਿਆਰੀ ਕਰ ਮੈਂ ਕਰਦੀ ਹਾਂ ਇਸ